ਭਾਰਤ ਦੀ ਸਰਕਾਰੀ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਹੈ ਪਰ ਭਾਰਤ ਦੀਆਂ ਭਾਸ਼ਾਵਾਂ ਹ ਬਹੁਤ ਹਨ ਇਹ ਸਾਨੂੰ ਇਹੋ ਜਿਹੇ ਦਸਤਾਵੇਜ਼ਾਂ ਜਾਂ ਭਾਸ਼ਾਵਾਂ ਦੀ ਲੋੜ ਹੈ ਜਿਹੜੇ ਸਾਨੂੰ ਲੋਕਾਂ ਨੂੰ ਸਮਝਣ ਅਤੇ ਸਮਝਾਉਣ ਵਿੱਚ ਅ ਸਹਾਇਤਾ ਮਿਲੇ ਜੇ ਸਾਡੇ ਅਹ ਜਿਹੜੇ ਆ ਡਾਕੂਮੈਂਟ ਹਨ ਉਹ ਜੇ ਪੰਜਾਬੀ 'ਚ ਜਾਂ ਸਾਡੀ ਖੇਤਰੀ ਭਾਸ਼ਾ ਦੇ ਵਿੱਚ ਹੋਣ ਤਾਂ ਜਿਹੜੇ ਆਪਣੇ ਲੋਕ ਆਮ ਲੋਕ ਹਨ ਉਹਨਾਂ ਨੂੰ ਇਹਨਾਂ ਨੂੰ ਸਮਝਣ ਦੇ ਵਿੱਚ ਸੁਵਿਧਾ ਹੋਵੇਗੀ ਨਹੀਂ ਤਾਂ ਸਾਨੂੰ ਕਿਸੇ ਨਾ ਕਿਸੇ ਤੋਂ ਇਹ ਪ ਪੁੱਛਣਾ ਪੈਂਦਾ ਹੈ ਕਿ ਸਾਨੂੰ ਇਹਦਾ ਕੀ ਕਰਨਾ ਹੈ ਜੇ ਇਹ ਹੀ ਸਾਡੀ ਖੇਤਰੀ ਭਾਸ਼ਾ ਹੋਏਗੀ ਤਾਂ ਸਾਨੂੰ ਇਹਨੂੰ ਸਮਝਣ ਭਰਨ ਅਤੇ ਉਹਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਮਿਲੇਗੀ ਸਾਨੂੰ ਆਪਣੀ ਜਿਹੜੀ ਭਾਸ਼ਾ ਹੈ ਸਰਕਾਰੀ ਭਾਸ਼ਾ ਉਹਨਾਂ ਨੂੰ ਵੱਧ ਤੋਂ ਵੱਧ ਅ ਅੱਗੇ ਵਧਾਉਣ ਲਈ ਜੇ ਅਸੀਂ ਸਰਕਾਰੀ ਕੰਮ ਆਪਣੀ ਖੇਤਰੀ ਭਾਸ਼ਾ ਦੇ ਵਿੱਚ ਕਰਦੇ ਰਹਾਂਗੇ ਤਾਂ ਇਸ ਨਾਲ ਸਾਡੀ ਸੁੱਖ ਸੁਵਿਧਾ ਵਧੇਗੀ ਅਤੇ ਅਸੀਂ ਆਪਣੇ ਜਿਹੜੇ ਹੱਕ ਹੈ ਜਾਂ ਕਹਿ ਲਓ ਜਿਹੜੀਆਂ ਆਪਣੀਆਂ ਸੁੱਖ ਸੁਵਿਧਾਵਾਂ ਲਈ ਆਪਾਂ ਅ ਸਰਕਾਰੀ ਦਫਤਰਾਂ ਦੇ ਵਿੱਚ ਗੇੜੇ ਮਾਰਦੇ ਦਫਤਰਾਂ ਉਹ ਸਭ ਘੱਟ ਜਾਣਗੇ